ਹੈਲੋ ਹਾਂਜੀ ਕਾਰ ਡਿੱਲਰ ਬੋਲਦੇ ਜੀ ਹਾਂਜੀ ਗੱਡੀ ਲੈਣੀ ਚਾਹੁੰਦਾ ਜੀ ਮੈਂ ਹਾਂਜੀ ਗੱਡੀ ਵਰਨਾ ਹੋਵੇ ਜਾਂ ਇਨੋਵਾ ਹੋਵੇ ਠੀਕ ਹੈ ਜੀ ਮੌ ਹਾਂਜੀ ਮੌਡਲ ਮੌਡਲ ਦੋ ਹਜ਼ਾਰ ਤੇਰਾਂ ਹੋਵੇ ਠੀਕ ਹੈ ਜੀ ਤਾਂ ਟੈਰ ਟੂਰ ਸਾਫ਼ ਹੋਣ ਗੱਡੀ ਸਾਫ਼ ਸੁਥਰੀ ਹੋਵੇ ਠੀਕ ਹੈ ਠੀਕ ਹੈ ਠੀਕ ਹੈ ਜੀ ਏਸੀ ਹੈ ਕਿ ਨੌਨ ਏਸੀ ਹੈ ਅੱਛਾ ਜੀ ਅਤੇ ਟਾਇਰ ਟੂਰ ਸਾਫ਼ ਹੈ ਜੀ ਟਾਇਰ ਸਾਫ਼ ਹੈ ਜੀ ਐਨ ਬਿਲਕੁਲ ਇੰਜਣ ਉੰਜਣ ਜੀ ਅੱਛਾ ਜੀ ਕ ਕਲਰ ਕਿਹੜਾ ਜੀ ਕਲਰ ਅੱਛਾ ਵ੍ਹਾਈਟ ਹੀ ਚਾਹੀਦਾ ਜੀ ਠੀਕ ਹੈ ਜੀ ਚਿੱਟਾ ਹੀ ਚਾਹੀਦਾ ਨਹੀਂ ਵ੍ਹਾਈਟ ਹੀ ਚਾਹੀਦਾ ਜੀ ਚਿੱਟਾ ਹੈ ਜੀ ਮੌਡਲ ਦੋ ਹਜ਼ਾਰ ਬਾਰਾਂ ਤੇਰਾਂ ਹੋਵੇ ਅਤੇ ਹਾਂਜੀ ਇੰਜਣ ਇੰਜਣ ਦਾ ਇੰਜਣ ਠੀਕ ਹੋਣਾ ਚਾਹੀਦਾ ਜੀ ਠੀਕ ਹੈ ਠੀਕ ਹੈ ਜੀ ਹੋਰ ਬਾਕੀ ਠੀਕ ਹੈ ਸਾਰਾ ਕੁਝ ਅੱਛਾ ਜੀ ਇੰਨਸ਼ੋਅਰੈਂਸ ਹੋਈ ਵੀ ਠੀਕ ਹੈ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ